ਜਿਵੇਂ ਕਿ ਅਸੀਂ ਪੰਜਾਬ ਖੇਤਰ ਨਾਲ ਸੰਬੰਧ ਰੱਖਦੇ ਹਾਂ ਇੱਥੇ ਬਹੁਤ ਸਾਰੇ ਮੌਸਮੀ ਤਿਉਹਾਰ ਮਨਾਏ ਜਾਂਦੇ ਆ ਜਿਵੇਂ ਕਿ ਲੋਹੜੀ ਦਾ ਤਿਉਹਾਰ ਮਾਘੀ ਬਸੰਤ ਹੋਲੀ ਵਿਸਾਖੀ ਗਣੇਸ਼ ਚਤੁਰਥੀ ਦੁਸਹਿਰਾ ਦਿਵਾਲੀ ਆਦਿ ਮਨਾਏ ਜਾਂਦੇ ਆ ਸਾਲ ਦੇ ਸ਼ੁਰੂਆਤ ਤੋਂ ਬਾਅਦ ਜਿਉਂ ਜਿਉਂ ਮੌਸਮ ਬਦਲਦਾ ਹੈ ਵੱਖੋ ਵੱਖ ਤਿਉਹਾਰ ਆਉਂਦੇ ਹਨ ਇਹ ਸਭ ਪੰਜਾਬ ਪ੍ਰਾਂਤ ਲਈ ਬਹੁਤ ਵਿਸ਼ੇਸ਼ ਹਨ ਸਭ ਤੋਂ ਪਹਿਲਾਂ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਆ ਸਰਦੀ ਹੋਣ ਕਰਕੇ ਲੋਕ ਰਾਤ ਨੂੰ ਲੱਕੜੀਆਂ ਦਾ ਭੁੱਗਾ ਬਾਲ ਕੇ ਉਸਦੇ ਆਲੇ ਦੁਆਲੇ ਚਾਰ ਚੁਫੇਰੇ ਬੈਠਦੇ ਹਨ ਅੱਗ ਸੇਕਦੇ ਹਨ ਅਤੇ ਮੂੰਗਫਲੀ ਰਿਉੜੀਆਂ ਗੁੜ ਗੱਚਕ ਆਦਿ ਨਾਲ ਨਾਲ ਬੈਠੇ ਖਾਂਦੇ ਹਨ ਘਰ ਵਿੱਚ ਜਿਸ ਤਰ੍ਹਾਂ ਕਿਸੇ ਦਾ ਵਿਆਹ ਹੋਇਆ ਹੋਵੇ ਜਾਂ ਕਿਸੇ ਬੱਚੇ ਦਾ ਜਨਮ ਹੋਇਆ ਹੋਵੇ ਤਾਂ ਲੋਹੜੀ ਮਨਾਉਂਦੇ ਆ ਉਸ ਦਿਨ ਲੋਹੜੀ ਵਾਲੇ ਦਿਨ ਕੁਝ ਲੋਕ ਤਾਂ ਬਹੁਤ ਕਰਦੇ ਆ ਕਿ ਜਿਸ ਤਰ੍ਹਾਂ ਕੁਝ ਖਾਣ ਪੀਣ ਦਾ ਪ੍ਰੋਗਰਾਮ ਕਰਦੇ ਆ ਔਰ ਡਾਂਸ ਡਾਂਸ ਦਾ ਪ੍ਰੋਗਰਾਮ ਵੀ ਰੱਖਿਆ ਹੁੰਦਾ ਡੀ ਜੇ ਵਗੈਰਾ ਲਗਾ ਕੇ ਡਾਂਸ ਵੀ ਕਰਦੇ ਆ ਬਹੁਤ ਕੁਝ ਮਨਾਉਂਦੇ ਆ ਉਸ ਦਿਨ ਘਰ ਵਿੱਚ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਆ ਅਤੇ ਇਸ ਦਾ ਤਿਉਹਾਰ ਇਸ ਤਰ੍ਹਾਂ ਮਨਾਇਆ ਜਾਂਦਾ ਲੋਹੜੀ ਦਾ ਤਿਉਹਾਰ ਔਰ ਇਸ ਦੇ ਵਿੱਚ ਰੋਹ ਵਾਲੀ ਖੀਰ ਖਿਚੜੀ ਸਰ੍ਹੋਂ ਦਾ ਸਾਗ ਇਹ ਵੀ ਬਣਾਇਆ ਜਾਂਦਾ ਹੈ ਨਾਲ ਇਹ ਤਿਉਹਾਰ ਸਰਦੀ ਦੇ ਮੌਸਮ ਦੇ ਨਾਲ ਸੰਬੰਧਿਤ ਹੈ ਇਸ ਤੋਂ ਬਾਅਦ ਬਸੰਤ ਪੰਚਮੀ ਦਾ ਤਿਉਹਾਰ ਆਉਂਦਾ ਆ ਬਸੰਤ ਪੰਚਮੀ ਵਾਲੇ ਦਿਨ ਕਹਿੰਦੇ ਆ ਕਿ ਆਈ ਬਸੰਤ ਅਤੇ ਪਾਲਾ ਉਡੰਤ ਇਸ ਤਰ੍ਹਾਂ ਦੀਆਂ ਕਹਾਵਤਾਂ ਵੀ ਬੋਲੀਆਂ ਜਾਂਦੀਆਂ ਹਨ ਕਿ ਸਰਦੀ ਤੋਂ ਕੁਛ ਰਾਹਤ ਮਿਲੇਗੀ ਨਹੀਂ ਤਾਂ ਕਈ ਵਾਰ ਤਾਂ ਇਸ ਤਰ੍ਹਾਂ ਹੁੰਦਾ ਕਿ ਬਸੰਤ ਦੇ ਅ ਆਉਣ 'ਤੇ ਪਾਲਾ ਫਿਰ ਯਾਨੀ ਕਿ ਸਰਦੀ ਫਿਰ ਆ ਜਾਂਦੀ ਹੈ ਉਸ ਤੋਂ ਰਾਹਤ ਨਹੀਂ ਮਿਲਦੀ ਔਰ ਇਸ ਤੋਂ ਬਾਅਦ ਦੇ ਵਿੱਚ ਗੱਲ ਕਰੀਏ ਤਾਂ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਆ ਹੋਲੀ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਕਿ ਰੰਗਾਂ ਦਾ ਤਿਉਹਾਰ ਹੈ ਔਰ ਇਸ ਦੇ ਵਿੱਚ ਰੰਗਾਂ ਦੇ ਨਾਲ ਖੇਡਿਆ ਜਾਂਦਾ ਆ ਹੋਲੀ ਦੇ ਆਉਣ 'ਤੇ ਥੋੜ੍ਹੀ ਗਰਮੀ ਮਹਿਸੂਸ ਕੀਤੀ ਜਾਂਦੀ ਹੈ ਔਰ ਮੌਸਮ ਦੇ ਕਰਵਟ ਬਦਲਣ ਦਾ ਵਧਣ ਲੱਗਦਾ ਆ ਔਰ ਇਸ ਤੋਂ ਬਾਅਦ ਵਿਸਾਖੀ ਅਪ੍ਰੈਲ ਦੇ ਮਹੀਨੇ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਆ ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਵਿਸਾਖੀ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ ਜਾਂਦੀ ਆ ਉਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀ ਅਤੇ ਉਹਨਾਂ ਕੋਲੋਂ ਆਪ ਅੰਮ੍ਰਿਤ ਛਕਿਆ ਸੀ ਔਰ ਇਸ ਦਿਨ ਵਿਸਾਖੀ ਵਾਲੇ ਦਿਨ ਕਣਕਾਂ ਪੱਕੀਆਂ ਹੁੰਦੀਆਂ ਨੇ ਤਾਂ ਕਣਕਾਂ ਦੀ ਕਟਾਈ ਵੀ ਇਸ ਦਿਨ ਤੋਂ ਹੀ ਸ਼ੁਰੂ ਕੀਤੀ ਜਾਂਦੀ ਆ ਔਰ ਉਸ ਦਿਨ ਤੋਂ ਗਰਮੀਆਂ ਬਹੁਤ ਹੀ ਸਮਝ ਲਉ ਕਿ ਜ਼ੋਰਾਂ 'ਤੇ ਆ ਕਿਉਂਕਿ ਕਣਕ ਪੱਕ ਜਾਂਦੀ ਹੈ ਇਸ ਕਰਕੇ ਔਰ ਇਸ ਦੇ ਨਾਲ ਨਾਲ ਬਾਅਦ ਦੇ ਵਿੱਚ ਫਿਰ ਤਿਉਹਾਰਾਂ ਦੀ ਗੱਲ ਕਰਦੇ ਹੋਏ ਦੁਸਹਿਰਾ ਵੀ ਆਉਂਦਾ ਆ ਫਿਰ ਦੁਸਹਿਰੇ 'ਤੇ ਵੀ ਲੋਕ ਬਹੁਤ ਮਤਲਬ ਮਨਾਉਂਦੇ ਉਸ ਨੂੰ ਫਿਰ ਦੁਸਹਿਰੇ ਤੋਂ ਬਾਅਦ ਗੱਲ ਕਰੀਏ ਤਾਂ ਦਿਵਾਲੀ ਦੀ ਦਿਵਾਲੀ ਵੀ ਦਿਵਾਲੀ ਵਾਲੇ ਦਿਨ 'ਤੇ ਬਹੁਤ ਹੀ ਰੌਣਕਾਂ ਹੁੰਦੀਆਂ ਨੇ ਹਰ ਘਰ ਵਿੱਚ ਦਿਵਾਲੀ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ ਜਾਂਦੀ ਹੈ ਔਰ ਪੰਜਾਬ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਤਿਉਹਾਰ ਮਨਾਏ ਜਾਂਦੇ ਆ